ਹਾਂਜੀ ਕੌਣ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਬਾਕੀ ਤਾਂ ਸਭ ਠੀਕ ਹੈ ਮੈਨੂੰ ਅਕਾਊਂਟਸ 'ਚ ਪ੍ਰੋਬਲਮ ਆ ਰਹੀ ਹੈ ਮੈਮ ਸਿਲੇਬਸ ਦੇ ਰਿਲੇਟਡ ਟੀਚਰ ਦੇ ਰਿਲੇਟਡ ਵੀ ਆ ਰਿਹਾ ਬਟ ਇਕਨੋਮਿਕਸ ਦੀ ਸਿਲੇਬਸ ਦੇ ਵਿੱਚ ਮੈਮ ਸ਼ੇਅਰ ਕੈਪੀਟਲ ਦੇ ਡਿਬੈਂਚਰ 'ਚ ਥੋੜ੍ਹੀ ਜਿਹੀ ਹੈਗੀ ਪ੍ਰੋਬਲਮ ਮੈਮ ਟੀਚਰ ਦਾ ਸੁਭਾਅ ਨਹੀਂ ਠੀਕ ਬਹੁਤ ਰੂਡਲੀ ਗੱਲ ਕਰਦੇ ਨੇ ਐਵੇਂ ਹੀ ਬੋਲਦੇ ਰਹਿੰਦੇ ਮਤਲਬ ਸੁਭਾਅ ਨਹੀਂ ਠੀਕ ਹੈਗਾ ਮੈਮ ਨੋ ਮੈਮ ਬਸ ਥੈਂਕ ਯੂ